ਹੈਲੋ ਹੈਲੋ ਵੀਰੇ ਓਰੇਨ ਤੋਂ ਬੋਲ ਰੇ ਓ ਸਰ ਜੀ ਉਹ ਅਪੋਆਇਨਮੈਂਟ ਕਰਵੋਣੀ ਸੀ ਮੈਂ ਆਪਣੀ ਵਾਈਫ ਲਈ ਹੇਅਰ ਕੈਰੋਟੀਨ ਕਰੋਣੀ ਸੀ

ਹਾਂਜੀ ਸਰ ਮੈਂ ਕੱਲ ਦੀ ਲੈਣੀ ਸੀਗੀ ਕੱਲ ਫੇਰ ਕਿੰਨੇ ਕ ਵਜੇ ਤੱਕ ਖੁਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੰਦਰਾਂ ਤਰੀਕ ਨੂੰ ਸਰ ਜੈਂਟਸ ਲਈ ਵੀ ਪੁੱਛਣਾ ਸੀ ਮੈਂ ਆਪਣੇ ਹੇਅਰ ਦਾ ਥੋੜਾ ਕਰਵਾਣੇ

ਹੇਅਰ ਕੱਟ ਵਗੈਰਾ ਦੋਨੇਂ ਈ ਕਰਨੇ ਹੈਗੇ ਐ ਕੈਮੀਕਲ ਵਰਕ ਵੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਤੇ ਜੇ ਆਪਾਂ ਕੱਲਾ ਰਿਬੋਨਡਿੰਗ ਕਰਵੋਣੀ ਹੋਏ ਫੇਰ ਜੀ ਅੱਛਾ ਜੀ ਅੱਛਾ ਸਰ ਹਾਂਜੀ ਸਰ ਅਸੀਂ ਦੋਨਾਂ ਨੇ ਈ ਕਰਵੋਨਾ ਸਾਨੂੰ ਸਰ ਟੋਟ ਓਫਰ ਨੀ ਮਿਲ ਸਕਦਾ ਜੇ ਆਪਾਂ ਦੋਨਾਂ ਨੂੰ ਕਰਵੋਨਾ ਹੋਏ ਹਾਂਜੀ ਹਾਂਜੀ ਕੈਰਾਟਿਨ ਰਿਬੋਨਡਿੰਗ ਵੀ ਕਰੁੰਗੇ ਅੱਛਾ ਜੀ ਹਾਂਜੀ ਕਲਰ ਵੀ ਕਰਵੋਣਾ ਜੀ ਫੈਸ਼ਨਸ਼ੀਟ ਅੱਛਾ ਜੀ ਸਰ ਐਸ਼ ਕਰਵੋਣਾ ਮੈਂ ਹਾਂਜੀ ਹਾਂਜੀ ਆਈਲੈਟ ਅੱਛਾ ਜੀ ਤੇ

ਸਰ ਇਹਦੀ ਕੋਈ ਜਿਵੇਂ ਪ੍ਰੋਡਕਟ ਦੀ ਜਿਵੇਂ ਆਪਾਂ ਕਹਿ ਸਕਦੇ ਆਂ ਉਹ ਸਾਈਡਰ ਇਫੈਕਟ ਤਾਂ ਨੀ ਸਰ ਵੀ ਜਿਵੇਂ ਅੱਜ ਕੱਲ ਬਹੁਤ ਸਾਰੇ ਅੱਛਾ ਜੀ ਸਰ ਗਰਾਂਟਿਡ ਵਗੈਰਾ ਜਿਵੇਂ ਆਪਾਂ ਵਾਲ ਕਲਰ ਕਿੰਨੇ ਕ ਟਾਈਮ ਤੱਕ ਰਹਿ ਸਕਦੇ ਇਹਦੀ ਟਾਈਮਿੰਗ ਦੱਸ ਅੱਛਾ ਜੀ ਅੱਛਾ ਜੀ ਸਰ ਜਿਵੇਂ ਆਪਾਂ ਹਾਂਜੀ ਅੱਛਾ ਜੀ ਹਾਂਜੀ ਸਰ ਅਸੀਂ ਪੰਦਰਾਂ ਤਰੀਕ ਨੂੰ ਆਜਾਂਗੇ ਜੀ ਇੱਕ ਵਾਰੀ ਤੁਸੀਂ ਪੰਦਰਾਂ ਤਰੀਕ ਨੂੰ ਆਜਾਂਗੇ ਜੀ ਇੱਕ ਵਰੀ ਥੋਨੂੰ ਵਧੀਆ ਲੱਗਿਆ ਜੀ ਥੋਡਾ ਓਫਰ ਤੇ ਹਾਂਜੀ ਓਕੇ ਸਰ ਥੈਂਕਿਊ ਸਰ ਜੀ